ਪੰਜਾਬ ਦੇ ਵਿੱਚ ਜਿਹੜੀ ਕਾਨੂੰਨੀ ਨਿਆਇਕ ਪ੍ਰਕਿਰਿਆ ਨੂੰ ਦੇਰੀ ਨੂੰ ਹੱਲ ਕਰਨ ਦੇ ਲਈ ਜਿਹੜੀਆਂ ਪਹਿਲਾਂ ਔਲ ਪੇਸ਼ੀਆਂ ਹੁੰਦੀਆਂ ਸੀਗੀਆਂ ਕੋਰਟ ਦੇ ਵਿੱਚ ਜਾਣਾ ਪੈਂਦਾ ਸੀਗਾ ਤਾਂ ਉਹ ਅੱਜ ਕੱਲ੍ਹ ਜਿਹੜੀਆਂ ਵੀਡੀਓ ਕੌਨਫਰੰਸ ਦੇ ਰਾਹੀਂ ਹੋ ਜਾਂਦੀਆਂ ਨੇ ਅਤੇ ਜੇ ਕਿਸੇ ਨੇ ਆਪਦੀ ਤਾਰੀਕ ਦਾ ਪਤਾ ਕਰਨਾ ਹੁੰਦਾ ਗਾ ਤਾਂ ਈ ਕੋਰਸ ਨਾਂ ਦੀ ਐਪ ਹੈਗੀ ਉਹ 'ਤੇ ਜਾ ਕੇ ਮਤਲਬ ਪਤਾ ਲੱਗ ਜਾਂਦਾ ਗਾ ਤਾਂ ਇਸੇ ਨਾਲ ਜਿਹੜਾ ਮਤਲਬ ਬੰਦਿਆਂ ਦੀ ਜਿਹੜੀ ਦੇਰੀ ਸੀਗੀ ਉਹਨਾਂ ਨੂੰ ਜਿਹੜਾ ਜਾਣਾ ਪੈਂਦਾ ਸੀਗਾ ਆਪਦਾ ਕੰਮ ਕਾਰ ਛੱਡ ਕੇ ਤਾਂ ਉਹ ਅੱਜ ਕੱਲ੍ਹ ਨਹੀਂ ਜਾਣਾ ਪੈਂਦਾ ਤਾਂ ਜਿਹੜੀ ਇਸ ਤਰੀਕੇ ਨਾਲ ਜਿਹੜਾ ਇਸ ਦੇਰੀ ਦੇ ਮੁੱਦੇ ਨੂੰ ਹੱਲ ਕੀਤਾ ਗਿਆ ਹੈਗਾ